ਅੱਜ ਕੱਲ੍ਹ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਦਿਆਰਥੀ ਦੂਜੇ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਵਿੱਚ ਨਾ ਜਾਣ ਤਕਰੀਬਤ ਤਕਰੀਬਨ ਕੋਸ਼ਿਸ ਇਹ ਹੁੰਦੀ ਹੈ ਕਿ ਘੱਟੋ ਘੱਟ ਜੋ ਅੱਠਵੀਂ ਦੀ ਸਿੱਖਿਆ ਹੈ ਉਹ ਹਰ ਇੱਕ ਪਿੰਡ ਵਿੱਚ ਉਪਲਬਧ ਕਰਵਾਈ ਜਾ ਸਕੇ ਪਰ ਫਿਰ ਵੀ ਦੇਖਣ ਵਿੱਚ ਇਹ ਆਇਆ ਕਿ ਹਰ ਇੱਕ ਪਿੰਡ ਵਿੱਚ ਮੈਟ੍ਰਿਕ ਪੱਧਰ ਜਾਂ ਸੀਨੀਅਰ ਸੈਕੰਡਰੀ ਪੱਧਰ ਦੀ ਪ੍ਰੀਖਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਹਰ ਇੱਕ ਪਿੰਡ ਵਿੱਚ ਇੰਨੇ ਬੱਚੇ ਨਹੀਂ ਹੁੰਦੇ ਗਿਣਤੀ ਨੂੰ ਮੁੱਖ ਰੱਖਦੇ ਹੋਏ ਵੀ ਹਾਈ ਸਕੂਲ ਜਾਂ ਸੀਨੀਅਰ ਸੈਕੰਡਰੀ ਸਕੂਲ ਬਣਾਏ ਜਾਂਦੇ ਹਨ ਬੱਚੇ ਐਂ ਜੋ ਬੱਚਿਆਂ ਨੂੰ ਬੱਸਾਂ ਦਾ ਪ੍ਰਬੰਧ ਨਹੀਂ ਹੈ ਬੱਚੇ ਆਪਣੇ ਸਾਧਨਾਂ 'ਤੇ ਹੀ ਸਕੂਲ ਪੜ੍ਹਨ ਲਈ ਜਾਂਦੇ ਹਨ ਜਿਸ ਵਿੱਚ ਬੱਚੇ ਸਾਈਕਲਾਂ 'ਤੇ ਜਾਂ ਅੱਜ ਕੱਲ੍ਹ ਆਵਾਜਾਈ ਦੇ ਸਾਧਨ ਹੋਣ ਕਾਰਨ ਮੋਟਰਸਾਈਕਲਾਂ 'ਤੇ ਵੀ ਬੱਚੇ ਸਿੱਖਿਆ ਗ੍ਰਹਿਣ ਕਰਨ ਲਈ ਜਾਂਦੇ ਹਨ ਦੋ ਜਾਂ ਚਾਰ ਪਿੰਡਾਂ ਨੂੰ ਮਿਲਾ ਕੇ ਇੱਕ ਸਕੂਲ ਇੱਕ ਹਾਈ ਸਕੂਲ ਬਣਾਇਆ ਜਾਂਦਾ ਹੈ ਤਾਂ ਸਿੱਖਿਆ ਪ੍ਰਾਪਤ ਕਰਨਾ ਅੱਜ ਦੇ ਸਮੇਂ ਲਈ ਅੱਜ ਦੇ ਸਮੇਂ ਵਿੱਚ ਸੌਖਾ ਹੈ ਔਖਾ ਨਹੀਂ ਹੈ ਕਿਉਂਕਿ ਹੁਣ ਆਵਾਜਾਈ ਦੇ ਸਾਧਨ ਬਹੁਤ ਹੋ ਚੁੱਕੇ ਹਨ ਪਹਿਲਾਂ ਸਿੱਖਿਆ ਕਰਨ ਸਿੱਖਿਆ ਪ੍ਰਾਪਤ ਕਰਨ ਲਈ ਜਦੋਂ ਦੂਜੇ ਪਿੰਡ ਜਾਣਾ ਪੈਂਦਾ ਸੀ ਉਦੋਂ ਪੈਦਲ ਹੀ ਜਾਣਾ ਪੈਂਦਾ ਸੀ ਉਦੋਂ ਬਹੁਤ ਔਖਾ ਸੀ ਖਾਸ ਕਰਕੇ ਬੱਚੀਆਂ ਲਈ ਬਹੁਤ ਔਖੀ ਸੀ ਸਿੱਖਿਆ ਪਰੰਤੂ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਸਾਈਕਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਬੱਚੀਆਂ ਨੂੰ ਸਾਈਕਲ ਦਿੱਤੇ ਗਏ ਹਨ ਤਾਂ ਕਿ ਬੱਚੀ ਬੱਚੇ ਆਪਣੀ ਸਿੱਖਿਆ ਪ੍ਰਾਪਤ ਕਰ ਸਕਣ